ਪੁਰਾਣੇ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਪਾਂ ਰੇਡੀਓ ਨੂੰ ਫਰਮਾਉਂਦੇ ਹਾਂ ਇਸ ਦੇ ਵਿੱਚ ਪੰਜਾਬੀ ਲੋਕ ਇਨ੍ਹਾਂ ਦੇ ਉੱਤੇ ਟੇਸ਼ਨ ਦੇ ਵਿੱਚ ਕਈ ਸਾਰੀਆਂ ਖਬਰਾਂ ਸੁਣਦੇ ਸਨ ਅਤੇ ਅੱਜ ਦੇ ਸਮੇਂ ਵਿੱਚ ਟੈਲੀਵਿਜ਼ਨ ਹੈ ਪ੍ਰੰਤੂ ਉਸ ਸਮੇਂ ਰੇਡੀਓ ਦੇ ਵਿੱਚ ਟੇਸ਼ਨ 'ਤੇ ਖਬਰਾਂ ਸੁਣੀਆਂ ਜਾਂਦੀਆਂ ਸਨ ਅਤੇ ਸਾਰੇ ਲੋਕ ਇੱਕ ਜਗ੍ਹਾ ਬੈਠ ਕੇ ਕੱਠੇ ਸੁਣਦੇ ਸਨ ਅਤੇ ਪੰਜਾਬੀ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਕਿਹੜਾ ਟੇਸ਼ਨ ਕਿੰਨੇ ਨੰਬਰ 'ਤੇ ਹੈ ਅਤੇ ਇਸੀ ਤਰ੍ਹਾਂ ਅੱਜ ਦੇ ਯੁੱਗ ਵਿੱਚ ਟੈਲੀਵਿਜ਼ਨ ਆ ਗਿਆ ਹੈ ਜਿਸ ਦੇ ਉੱਤੇ ਸਾਰਾ ਕੁਝ ਸੁਣਨ ਦੇ ਨਾਲ਼ ਨਾਲ਼ ਦਿਖਾਈ ਵੀ ਦਿੰਦਾ ਹੈ ਅਤੇ ਜਿਸ ਦੀ ਤਰੱਕੀ ਦਿਨੋ ਦਿਨ ਵੱਧ ਵੀ ਬਹੁਤ ਰਹੀ ਹੈ ਟੈਲੀਵਿਜ਼ਨ 'ਤੇ ਅਸੀਂ ਆਪਣਾ ਇੰਟਰਟੇਨਮੈਂਟ ਕਰ ਸਕਦੇ ਹਾਂ ਇਸ ਦੇ ਉੱਤੇ ਪੰਜਾਬੀ ਹਿੰਦੀ ਮਰਾਠੀ ਉਰਦੂ ਅਤੇ ਹੋਰ ਵੀ ਕਈ ਭਾਸ਼ਾਵਾਂ ਦੇ ਚੈਨਲ ਚੱਲਦੇ ਹਨ ਅਤੇ ਇਸ ਵਿੱਚ ਪੰਜਾਬੀ ਦੇ ਵੀ ਪੰਦਰਾਂ ਵੀਹ ਚੈਨਲ ਅਲੱਗ ਦਿੱਤੇ ਗਏ ਹਨ ਜਿਸ ਤਰ੍ਹਾਂ ਬਾਕੀ ਭਾਸ਼ਾਵਾਂ ਦੇ ਵੀ ਇਸੀ ਤਰ੍ਹਾਂ ਵੱਖ ਵੱਖ ਚੈਨਲ ਦਿੱਤੇ ਗਏ ਹਨ ਅਤੇ ਜਿਸ ਦੇ ਨਾਲ਼ ਮਨੋਰੁੱਖ ਦਾ ਮੰਨੋਰੰਜਨ ਅਤੇ ਖਬਰਾਂ ਦਾ ਤਰੋ ਤਾਜ਼ਾ ਮੰਨੋਰੰਜਨ ਵੀ ਹੋ ਜਾਂਦਾ ਹੈ